ਤਾਂ ਮੈਂ ਹਾਲੀ ਵਿੱਚ ਇੱਕ ਜੈਕੇਟ ਖਰੀਦੀ ਸੀ ਆਪਣੇ ਪਾਉਣ ਦੇ ਲਈ ਕਿਉਂਕਿ ਸਰਦੀਆਂ ਬਹੁਤ ਆ ਗਈਆਂ ਨੇ ਤਾਂ ਇੱਕ ਔਨਲਾਈਨ ਵੈਬਸਾਈਟ ਤੋਂ ਮੈਂ ਇੱਕ ਜੈਕੇਟ ਖਰੀਦੀ ਜਿਸ ਦਾ ਮੁੱਲ ਤਕਰੀਬਨ ਤਕਰੀਬਨ ਪੰਜ ਹਜ਼ਾਰ ਰੁਪਏ ਸੀ ਜਦ ਮੈਂ ਜੈਕੇਟ ਖਰੀਦੀ ਤਾਂ ਮੇਰੇ ਮਾਤਾ ਜੀ ਨੇ ਮੈਨੂੰ ਕਿਹਾ ਵੀ ਆਮ ਆਦਮੀ ਦੇ ਹਿਸਾਬ ਸਿਰ ਇਹ ਜੈਕੇਟ ਬਹੁਤ ਜ਼ਿਆਦਾ ਮਹਿੰਗੀ ਹੈ ਮਤਲਬ ਚਾਰ ਪੰਜ ਹਜ਼ਾਰ ਦੀ ਇਕੱਲੀ ਇੱਕ ਜੈਕਟ ਪਰ ਮੈਂ ਉਹਨਾਂ ਨੂੰ ਸਮਝਾਇਆ ਕਿ ਕਈ ਵਾਰ ਕੁਛ ਜਿਹੜੇ ਬ੍ਰਾਂਡ ਹੁੰਦੇ ਨੇ ਉਹਨਾਂ ਦੀਆਂ ਚੀਜ਼ਾਂ ਖਾਸ ਕਰਕੇ ਕਹਿ ਲਉ ਜਿਵੇਂ ਜ਼ਾਰਾ ਹੋ ਗਿਆ ਜਾਂ ਐਚ ਐਨ ਐਮ ਹੋ ਗਿਆ ਇਸ ਤਰੀਕੇ ਦੀਆਂ ਜਿਹੜੀਆਂ ਬਰਾਂਡ ਦੀਆਂ ਜੈਕਟਿਸ ਹੁੰਦੀਆਂ ਨੇ ਉਹ ਮਹਿੰਗੀਆਂ ਹੀ ਹੁੰਦੀਆਂ ਨੇ ਪਰ ਇਹਨਾਂ ਨੂੰ ਲੈਣ ਦਾ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਜਿਹੜੀ ਨੋਰਮਲ ਜੈਕਿਟਸ ਆਪਾਂ ਕਈ ਵਾਰ ਉਂਝ ਲੈ ਲੈਂਦੇ ਹਾਂ ਪੰਜ ਛੇ ਸੌ ਰੁਪਏ ਦੇ ਵਿੱਚ ਉਹ ਜੈਕਿਟਸ ਇੰਨੀਆਂ ਗਰਮ ਨਹੀਂ ਹੁੰਦੀਆਂ ਨਾਲੇ ਉਹਨਾਂ ਦਾ ਵੇਟ ਵੀ ਕਾਫੀ ਹੁੰਦਾ ਹੈ ਪਰ ਜਿਹੜੀਆਂ ਆਪਾਂ ਕਹਿ ਲਉ ਵਧੀਆ ਕੁਆਲਿਟੀ ਦੀਆਂ ਜੈਕਿਟਸ ਲੈਂਦੇ ਹਾਂ ਕਈ ਵਾਰ ਉਹ ਇੱਕ ਤਾਂ ਵੇਟ ਵਿੱਚ ਲਾਈਟ ਹੁੰਦੀਆਂ ਨੇ ਅਤੇ ਦੂਸਰਾ ਉਹ ਗਰਮ ਬਹੁਤ ਹੁੰਦੀਆਂ ਨੇ ਤਾਂ ਕਹਿ ਲਉ ਵੀ ਤੁਸੀਂ ਇੱਕ ਵਾਰ ਜੈਕਿਟ ਲੈ ਲਈ ਤਾਂ ਉਹ ਘੱਟੋ ਘੱਟ ਤੁਹਾਡੇ ਪੰਜ ਛੇ ਸਾਲ ਤੋਂ ਉੱਪਰ ਜਿਹੜਾ ਹੈ ਸਾਰ ਦਿੰਦੀ ਹੈ ਕੰਮ ਮੈਂ ਇਹ ਨਹੀਂ ਕਹਿ ਰਹੀ ਵੀ ਹਮੇਸ਼ਾ ਮਹਿੰਗੀਆਂ ਜੈਕਿਟਸ ਹੀ ਵਧੀਆ ਹੁੰਦੀਆਂ ਨੇ ਕਈ ਕਦੇ ਕਦੇ ਤੁਹਾਨੂੰ ਬਜ਼ਾਰ 'ਚ ਘੁੰਮਦਿਆਂ ਹੋਇਆਂ ਕੋਈ ਨੋਰਮਲ ਜੈਕਿਟ ਨੋਰਮਲ ਪ੍ਰਈਜ਼ ਦੇ ਵਿੱਚ ਵੀ ਅੱਛੀ ਮਿਲ ਜਾਂਦੀ ਹੈ ਪਰ ਯੂਜੂਅਲੀ ਮੈਂ ਪ੍ਰੈਫਰ ਕਰਦੀ ਹਾਂ ਕਿ ਜੇ ਤੁਸੀਂ ਇਹੋ ਜਿਹੀ ਚੀਜ਼ 'ਤੇ ਇਨਵੈਸਟ ਕਰਨਾ ਤਾਂ ਜ਼ਰੂਰ ਕੋਈ ਚੰਗੇ ਬ੍ਰਾਂਡ ਦੀ ਚੀਜ਼ ਲਉ ਜਾਂ ਥੋੜ੍ਹੇ ਬਹੁਤ ਪੈਸੇ ਖਰਚ ਕੇ ਚੀਜ਼ ਲਉ ਉਹਦੇ ਨਾਲ ਇਹ ਹੁੰਦਾ ਹੈ ਕਿ ਇੱਕ ਤਾਂ ਤੁਹਾਨੂੰ ਵਾਰ ਵਾਰ ਪੈਸੇ ਨਹੀਂ ਲਾਉਣੇ ਪੈਂਦੇ ਅਤੇ ਤੁਸੀਂ ਖੱਜਲ ਖੁਆਰ ਨਹੀਂ ਹੁੰਦੇ ਵਾਰ ਵਾਰ ਚੀਜ਼ਾਂ ਲੱਭਣ ਵਾਸਤੇ ਇੱਕੋ ਵਾਰ ਚੀਜ਼ ਲੀਤੀ ਤੁਹਾਡੀ ਕਿੰਨੀਆਂ ਚੀਜ਼ਾਂ ਨਾਲ ਪੈ ਜਾਂਦੀ ਹੈ ਅਤੇ ਉਸ ਤੋਂ ਬਾਅਦ ਮੈਂ ਪ੍ਰੈਫਰ ਕਰਦੀ ਹਾਂ ਵੀ ਜੈਕਿਟਡ ਦੇ ਵਿੱਚ ਬਲੈਕ ਕਲਰ ਜਾਂ ਬੇੲਚ ਕਲਰ ਜਾਂ ਬਰਾਊਨ ਜਾਂ ਨੇਵੀ ਬਲੂ ਇਹ ਕਲਰ ਲਿੱਤੇ ਜਾਣ ਕਿਉਂਕਿ ਇਹ ਜਿਹੜੇ ਕਲਰਸ ਹੁੰਦੇ ਨੇ ਤੁਹਾਡੇ ਕਿੰਨੇ ਕੱਪੜਿਆਂ ਨਾਲ ਇੱਕੋ ਹੀ ਕਲਰ ਆਹ ਵਾਲਾ ਚੱਲ ਜਾਂਦਾ ਹਰ ਹਰ ਕਿਸੇ ਨਾਲ ਸੋਹਣੇ ਲੱਗਦੇ ਨੇ ਜਿਵੇਂ ਗ੍ਰੇ ਕਲਰ ਲੈ ਸਕਦੇ ਹਾਂ ਹੈ ਨਾ ਤਾਂ ਬਸ ਆਹੀ ਮੇਰਾ ਐਕਸਪੀਰੀਅੰਸ ਸੀਗਾ ਤਾਂ ਠੰਡ ਚੱਲ ਰਹੀ ਹੈ ਜ਼ਰੂਰ ਜੈਕਟਾਂ ਖਰੀਦੀਏ ਵਧੀਆ ਵਧੀਆ ਕੰਪਨੀਜ਼ ਦੀਆਂ ਖਰੀਦੀਏ ਅਤੇ ਗਰਮ ਰਹੀਏ